ਮੈਂ ਆਪਣੀ ਗਾਇਕੀ ਦਾ ਅਭਿਆਸ ਹਰਮੋਨੀਅਮ ਨਾਲ ਕਰਦੀ ਹਾਂ ਮੈਂ ਆਪਣਾ ਅਭਿਆਸ ਸ਼ਾਮ ਦੇ ਸਮੇਂ ਤਾਂ ਕਰ ਜ਼ਰੂਰ ਕਰਦੀ ਹਾਂ ਅਤੇ ਕਿਉਂਕਿ ਮੈਂ ਨੌਕਰੀ ਕਰਦੀ ਹਾਂ ਤਾਂ ਦਿਨ 'ਚ ਮੇਰੇ ਕੋਲ ਸਮਾਂ ਨਹੀਂ ਹੁੰਦਾ ਸਵੇਰੇ ਇੰਨੀ ਭੱਜ ਦੌੜ ਹੁੰਦੀ ਆ ਕਿ ਸਵੇਰ ਦੇ ਸਮੇਂ ਮੈਂ ਚਾਹੁੰਦੇ ਹੋਏ ਅਭਿਆਸ ਨਹੀਂ ਕਰ ਸਕਦੀ ਇਸ ਲਈ ਮੈਨੂੰ ਹੁੰਦਾ ਕਿ ਸ਼ਾਮ ਨੂੰ ਫਿਰ ਮੈਂ ਅਭਿਆਸ ਕਰਾਂ ਹੀ ਕਰਾਂ ਹਾਂ ਛੁੱਟੀ ਵਾਲਾ ਦਿਨ ਆਉਂਦਾ ਤਾਂ ਉਦੋਂ ਮੈਨੂੰ ਜ਼ਰੂਰ ਹੁੰਦਾ ਕਿ ਮੈਂ ਸਵੇਰ ਨੂੰ ਸਮਾਂ ਕੱਢਾਂ ਕਿ ਮੈਂ ਅਭਿਆਸ ਕਰਾਂ ਉਹ ਛੁੱਟੀ ਵਾਲੇ ਦਿਨ 'ਚ ਤਾਂ ਮੈਂ ਦੁਪਹਿਰ ਨੂੰ ਵੀ ਅਗਰ ਸਮਾਂ ਲੱਗਦਾ ਤਾਂ ਮੈਂ ਅਭਿਆਸ ਜ਼ਰੂਰ ਕਰਦੀ ਹਾਂ ਬਾਕੀ ਸ਼ਾਮ ਦੀ ਤਾਂ ਮੇਰੀ ਰੂਟੀਨ ਆ ਕਿ ਮੈਂ ਅਭਿਆਸ ਕਰਾਂ ਹੀ ਕਰਾਂ ਉਹ ਮੇਰਾ ਛੁੱਟੇ ਨਾ ਕਿਉਂਕਿ ਮੈਨੂੰ ਗਾਇਕੀ ਦਾ ਇੰਨਾ ਸ਼ੌਂਕ ਆ ਕਿ ਜੇ ਮੇਰਾ ਇੱਕ ਵੀ ਨਾਗਾ ਹੁੰਦਾ ਤਾਂ ਮੈਨੂੰ ਬੜਾ ਖਾਲੀਪਨ ਲੱਗਦਾ ਕਿ ਪਤਾ ਨਹੀਂ ਕੀ ਹੋ ਗਿਆ ਮੇਰੇ ਨਾਲ ਕਿਹੜੀ ਚੀਜ਼ ਮੇਰੀ ਅਧੂਰੀ ਰਹਿ ਗਈ ਅਤੇ ਇਹੀ ਰੱਖਦੀ ਆ ਕਿ ਨਹੀਂ ਅਭਿਆਸ ਨਹੀਂ ਛੁੱਟਣਾ ਚਾਹੀਦਾ ਪਰ ਹਾਂ ਕਈ ਵਾਰੀ ਬੜੀਆਂ ਮੁਸ਼ਕਿਲਾਂ ਆ ਜਾਂਦੀਆਂ ਜਾਂ ਮੈਂ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਜਾਣਾ ਉੱਥੋਂ ਆਉਂਦੇ ਹਾਂ ਤਾਂ ਕਈ ਵਾਰ ਲੇਟ ਹੋ ਜਾਈਦਾ ਕਿ ਰਾਤ ਨੂੰ ਆ ਕੇ ਉਹ ਸਹੀ ਨਹੀਂ ਲੱਗਦਾ ਕਿ ਮੈਂ ਆਪਣਾ ਅਭਿਆਸ ਕਰ ਸਕਾਂ ਉਹ ਸਮਾਂ ਨਹੀਂ ਬਣਦਾ ਉਦੋਂ ਮੇਰਾ ਅਭਿਆਸ ਛੁੱਟ ਜਾਂਦਾ ਜਾਂ ਘਰ 'ਚ ਕਈ ਵਾਰ ਮਹਿਮਾਨ ਆਉਂਦੇ ਆ ਤਾਂ ਉਹਨਾਂ ਨਾਲ ਸਮਾਂ ਸਾਰਾ ਨਿਕਲ ਜਾਂਦਾ ਉਦੋਂ ਮੇਰੇ ਕੋਲ ਅਭਿਆਸ ਹੀ ਨਹੀਂ ਹੁੰਦਾ ਅਤੇ ਜਦੋਂ ਅਭਿਆਸ ਨਹੀਂ ਹੁੰਦਾ ਉਦੋਂ ਮੈਨੂੰ ਆਪਣੇ ਆਪ 'ਚੋਂ ਉਦਾਸੀ ਲੱਗਦੀ ਤਾਂ ਜ਼ਰੂਰ ਆ ਪਰ ਉਹ ਵੀ ਜ਼ਰੂਰੀ ਆ ਕਿ ਜਿਹੜੇ ਕੰਮ ਹੁਣ ਬਣੇ ਆ ਉਹ ਕਰਨੇ ਹੀ ਕਰਨੇ ਆ ਬਾਕੀ ਕੋਸ਼ਿਸ਼ ਤਾਂ ਇਹੀ ਰੱਖਦੀ ਹਾਂ ਨਾ ਛੁੱਟੇ ਪਰ ਛੁੱਟਦਾ ਅਭਿਆਸ ਜ਼ਰੂਰ ਆ